ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਡਮ ਅੱਛਾ ਜੀ ਅੱਛਾ ਜੀ ਹਾਂਜੀ ਹੈਗਾ ਅੱਛਾ ਮੈਡਮ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਜਿਹੜੇ ਮਰਜ਼ੀ ਲਓ ਜੀ ਹਾਂਜੀ ਲੇਡੀਜ਼ ਵੀ ਮਿਲਦੇ ਆ ਜੈਂਟਸ ਵੀ ਬੱਚਿਆਂ ਵਾਲੇ ਵੀ ਠੀਕ ਹੈ ਹਾਂਜੀ ਹਾਂਜੀ ਮਿਲ ਜਾਣਗੇ ਮੈਡਮ ਸਾਰੇ ਤਰ੍ਹਾਂ ਦੇ ਹਾਂਜੀ ਮੈਡਮ ਸਾਰੇ ਬ੍ਰਾਂਡ ਬਹੁਤ ਵਧੀਆ ਮੈਡਮ ਤੁਸੀਂ ਆਓ ਜੀ ਦੇਖੋ ਆ ਕੇ ਵਿਜ਼ਿਟ ਕਰੋ ਫਿਰ ਹਾਂਜੀ ਹਾਂਜੀ ਮੈਡਮ ਅੱਛਾ ਮੈਮ ਹਾਂਜੀ ਮੈਮ ਨਹੀਂ ਬਹੁਤ ਵਧੀਆ ਨੇ ਜੀ ਸਾਰੀਆਂ ਕੁਆਲਿਟੀਆਂ ਨੇ ਆਪਣੇ ਕੋਲ ਵਧੀਆ ਬ੍ਰਾਂਡ ਵੀ ਸਾਰੇ ਤਰ੍ਹਾਂ ਦੇ ਨੇ ਤੁਸੀਂ ਜਿਹੋ ਜਿਹੇ ਤੁਹਾਨੂੰ ਚੰਗੇ ਹਾਂਜੀ ਡਿਸਕਾਊਂਟ ਵਗੈਰਾ ਵੀ ਮੈਡਮ ਹੈਗਾ ਨਾ ਜਿਵੇਂ ਤੁਸੀਂ ਹਾਂਜੀ ਹਾਂਜੀ ਮੈਡਮ ਸਾਰੇ ਸਾਈਜ਼ ਵੀ ਮਿਲ ਜਾਣਗੇ ਤੁਹਾਨੂੰ ਹਾਂਜੀ ਜੋ ਮਰਜ਼ੀ ਸਾਈਜ਼ ਤੁਸੀਂ ਲੈ ਸਕਦੇ ਹੋਗੇ ਹਾਂਜੀ ਹਾਂ ਮੈਡਮ ਆਇਓ ਜੀ ਤੁਸੀਂ ਵਿਜ਼ਿਟ ਕਰਿਓ ਹਾਂਜੀ ਹਾਂਜੀ ਹਾਂਜੀ ਮੈਡਮ ਕੋਈ ਗੱਲ ਨਹੀਂ ਤੁਸੀਂ ਆਇਓ ਵਿਜ਼ਿਟ ਕਰਿਓ ਹਾਂਜੀ ਜਿਹੋ ਜਿਹੀ ਚੀਜ਼ ਚਾਹੀਦੀ ਤੁਹਾਨੂੰ ਦੇਵਾਂਗੇ ਓਕ ਓਕੇ ਮੈਮ ਓਕੇ